ਹਾਲ ਹੀ ਦੇ ਵਿੱਚ ਸ਼ਾਕਾਹਾਰੀ ਲੋਕਾਂ ਦਾ ਇਸ ਕਾਰੋਬਾਰ ਵਿੱਚ ਕੋਈ ਪ੍ਰਭਾਵ ਨਹੀਂ ਪਿਆ ਕਿਉਂਕਿ ਜਿਹੜੇ ਸ਼ਾਕਾਹਾਰੀ ਲੋਕ ਨੇ ਇਹ ਵੀ ਹੈ ਨਾ ਵੀ ਹੁਣ ਜਿਵੇਂ ਅੱਜ ਕੱਲ੍ਹ ਲੋਕਾਂ ਨੂੰ ਕਿੰਨੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਅਤੇ ਡੋਕਟਰ ਵੀ ਇਹਨਾਂ ਨੂੰ ਪ੍ਰੋਟੀਨ ਖਾਣ ਵਾਸਤੇ ਦੱਸਦੇ ਨੇ ਮਾਸ ਮੱਛੀ ਆਂਡਾ ਖਾਣ ਵਾਸਤੇ ਦੱਸਦੇ ਨੇ ਅਤੇ ਹੁਣ ਅੱਜ ਕੱਲ੍ਹ ਮਸ਼ੀਨੀ ਯੁੱਗ ਆ ਗਿਆ ਜਿਵੇਂ ਅੱਗੇ ਲੋਕ ਹੱਥੀਂ ਹੈ ਨਾ ਪੋਲਟਰੀ ਫਾਰਮ ਦੇ ਵਿੱਚ ਵੀ ਆਂਡੇ ਵੀ ਵਧਾਉਂਦੇ ਸੀ ਅਤੇ ਹੁਣ ਮਸ਼ੀਨੀ ਯੁੱਗ ਦੇ ਕਾਰਨ ਹੁਣ ਉਹ ਮਸ਼ੀਨਾਂ ਦੇ ਵਿੱਚ ਆਂਡੇ ਰੱਖ ਰੱਖ ਕੇ ਹੀ ਕਾਫ਼ੀ ਆਂਡਿਆਂ ਨੂੰ ਹੈ ਨਾ ਤੋਂ ਚੂਚੇ ਤਿਆਰ ਕਰ ਲੈਂਦੇ ਨੇ ਅਤੇ ਉਹਨਾਂ ਨੇ ਹੁਣ ਮਸ਼ੀਨੀ ਯੁੱਗ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਕਾਰੋਬਾਰ ਪ੍ਰਭਾਵਿਤ ਕੀਤਾ ਹੈ ਅਤੇ ਜਿਹੜਾ ਸ਼ਾਕਾਹਾਰੀ ਨੇ ਕਾਰੋਬਾਰ ਇਹਨਾਂ ਦੇ ਵਿੱਚ ਕੋਈ ਪ੍ਰਭਾਵਿਤ ਨਹੀਂ ਹੋਇਆ ਕਿਉਂਕਿ ਲੋਕਾਂ ਨੂੰ ਮਾਸ ਮੱਛੀ ਆਂਡੇ ਦੀ ਬਹੁਤ ਲੋੜ ਹੈ ਖਾਣ ਦੀ ਹੈ ਨਾ ਅਤੇ ਅੱਜ ਕੱਲ੍ਹ ਦੇ ਕੁਝ ਜਿਵੇਂ ਸਰੀਰਾਂ ਦੇ ਵਿੱਚ ਲੋਕਾਂ ਨੂੰ ਹੈ ਨਾ ਪ੍ਰੋਟੀਨ ਦੀ ਲੋੜ ਹੈ ਤਾਂ ਲੋਕਾਂ ਨੂੰ ਇਸ ਦੇ ਵਿੱਚ ਮਾਸ ਮੱਛੀ ਆਂਡਾ ਖਾਣਾ ਵੀ ਬਹੁਤ ਜ਼ਰੂਰੀ ਦੱਸਿਆ ਜਾਂਦਾ ਹੈ ਅਤੇ ਸਾਨੂੰ ਇਸ ਕਰਕੇ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਧੰਨਵਾਦ ਜੀ